ਹੈਲੋ ਹੈਲੋ ਹੈਲੋ ਤੁਸੀਂ ਹਰਿਮੰਦਰ ਸਾਹਿਬ ਦੇ ਮੈਨੇਜਰ ਗੱਲ ਕਰਦੇ ਪਏ ਹੋ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਰਾਜਸਥਾਨ ਤੋਂ ਗੱਲ ਕਰਦੇ ਪਏ ਹਾਂ ਮੈਂ ਤੁਹਾਨੂੰ ਪੁੱਛਣਾ ਸੀ ਕਿ ਅਸੀਂ ਨਾ ਅ ਭਾਂਡਿਆਂ ਦੀ ਸੇਵਾ ਕਰਨੀ ਆ ਅਸੀਂ ਕਰ ਸਕਦੇ ਹਾਂ ਅਤੇ ਹੋਰ ਸਾਨੂੰ ਕਿਹੜੀ ਕਿਹੜੀ ਸੇਵਾ ਜਿਹੜੀ ਮਿਲ ਸਕਦੀ ਆ ਠੀਕ ਹੈ ਜੀ ਜਿਹੜੇ ਲ ਮਤਲਬ ਉਹਨਾਂ ਦੇ ਕੋਲ ਗੁਰਦੁਆਰਾ ਸਾਹਿਬ ਅਸੀਂ ਉਹ ਵੀ ਦੇਖ ਸਕਦੇ ਹਾਂ ਠੀਕ ਹੈ ਜੀ ਅਤੇ ਮੈਂ ਜਿਹੜੀ ਮਤਲਬ ਸੇਵਾ ਪਾਵਾਂਗੀ ਪੈਸੇ ਦੀ ਉਹ ਮੈਨੂੰ ਰਸੀਦ ਮਿਲੇਗੀ ਉਸ ਦੀ ਠੀਕ ਆ ਹੋਰ ਮੈਨੂੰ ਕਿਹੜੀ ਕਿਹੜੀ ਸੇਵਾ ਜਿਹੜੀ ਮਿਲ ਸਕਦੀ ਆ ਅਤੇ ਮੈਨੂੰ ਰੈ ਰੈ ਹਾਂਜੀ ਮੈਂ ਰਹਿਣਾ ਵੀ ਚਾਹੁੰਦੀ ਹਾਂ ਅਤੇ ਮੈਨੂੰ ਰੂਮ ਮਿਲੇਗਾ ਰਹਿਣ ਵਾਸਤੇ ਠੀਕ ਆ ਜੀ ਚਲੋ ਠੀਕ ਹੈ ਫਿਰ ਅਸੀਂ ਤੁਹਾਨੂੰ ਫਿਰ ਦੱਸ ਦਾਂਗੇ ਹਾਂਜੀ ਓਕੇ ਜੀ ਓਕੇ